ਹੈਲੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਮੇਰੇ ਦੰਦ 'ਚ ਨਾ ਬਹੁਤ ਜ਼ਿਆਦਾ ਦਰਦ ਹੈ ਜੀ ਅਤੇ ਪਿਛਲੇ ਕਾਫੀ ਦਿਨਾਂ ਤੋਂ ਹੋ ਰਿਹਾ ਸਰ ਅਤੇ ਉਸ ਬਾਰੇ ਤੁਸੀਂ ਮੈਂ ਤੁਹਾਡੇ ਕੋਲ ਇਲਾਜ ਕਰਾਉਣਾ ਸੀ ਜੀ ਅਤੇ ਰਿਪੋਟ ਮੈਂ ਲੈਣੀ ਸੀ ਜੀ ਕਦੋਂ ਆਵਾਂ ਸਰ ਕੱਲ੍ਹ ਸੁਬਹੇ ਕਿੰਨੇ ਵਜੇ ਸਰ ਨੌ ਵਜੇ ਸਰ ਠੀਕ ਹੈ ਸਰ ਅਤੇ ਸਰ ਮੰਨ ਲਓ ਨੌਂ ਵਜੇ ਨਾ ਆਇਆ ਗਿਆ ਤਾਂ ਅੱਗੇ ਪਿੱਛੇ ਵੀ ਹੋ ਸਕਦਾ ਸਰ ਇੱਕੋ ਟਾਈਮ ਹੁੰਦਾ ਅੱਛਾ ਜੀ ਕਿੰਨੇ ਵਜੇ ਤੱਕ ਕਿੰਨੇ ਵਜੇ ਤੱਕ ਕਲੀਨਿਕ 'ਤੇ ਹੁੰਦੇ ਹੋ ਸਰ ਤੁਸੀਂ ਅੱਛਾ ਅੱਛਾ ਜੀ ਅਤੇ ਡਾਕਟਰ ਸਾਹਿਬ ਤੁਸੀਂ ਦੱਸ ਸਕਦੇ ਹੋ ਦੰਦਾਂ 'ਚ ਦਰਦ ਜ਼ਿਆਦਾ ਕਿਸ ਕਰਕੇ ਹੁੰਦਾ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਹੁਣ ਪਹਿਲਾਂ ਓਥੇ ਪਿੰਡ 'ਚੋਂ ਲਈ ਸੀ ਦਵਾਈ ਸਰ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਤੁਸੀਂ ਨਾ ਜ ਕਿਸੇ ਚੰਗੇ ਡੋਕਟਰ ਕੋਲ ਦਿਖਵਾਓ ਅਤੇ ਉਹਨਾਂ ਨੇ ਤੁਹਾਡਾ ਨੰਬਰ ਦੇ ਤਾ ਮੈਨੂੰ ਅਤੇ ਕਹਿੰਦੇ ਉਹ ਡੋਕਟਰ ਸਾਹਿਬ ਬਹੁਤ ਵਧੀਆ ਹੈਗੇ ਨੇ ਦਵਾਈ ਵੀ ਵਧੀਆ ਦਿੰਦੇ ਟ੍ਰੀਟਮੈਂਟ ਵੀ ਚੰਗਾ ਕਰਦੇ ਆ ਤਾਂ ਕਰਕੇ ਸਰ ਮੈਂ ਅਪੋਇੰਟਮੈਂਟ ਲੈਣ ਵਾਸਤੇ ਅੱਜ ਕਾਲ ਕੀਤੀ ਸੀ ਸਰ ਅਤੇ ਹਾਂਜੀ ਹਾਂਜੀ ਸਰ ਸਰ ਆਪਣੀ ਅਪੋਇੰਟਮੈਂਟ ਦੀ ਫੀਸ ਹੈਗੀ ਆ ਸਰ ਅਪੋਇੰਟਮੈਂਟ ਲੈਣ ਦੀ ਵੀ ਫੀਸ ਹੈਗੀ ਆ ਸਰ ਅੱਛਾ ਅੱਛਾ ਜੀ ਮਤਲਬ ਜਿੰਨੀ ਦਵਾਈ ਦਵਾਂਗੇ ਉਨੀ ਫੀਸ ਹੈ ਸਰ ਅਤੇ ਸਰ ਉਹ ਦਵਾਈ ਤੁਸੀਂ ਦੇਸੀ ਦੇਓਗੇ ਜਾਂ ਕੋਈ ਮਰਜ਼ੀ ਦਵਾਈ ਅੱਛਾ ਜੀ ਹਾਂਜੀ ਅਤੇ ਠੀਕ ਹੈ ਸਰ ਅਤੇ ਮੈਂ ਕੱਲ੍ਹ ਪੱਕਾ ਹੀ ਫਿਰ ਆਉਂਗਾ ਸਵੇਰੇ ਅਤੇ ਸਰ ਕੱਲ੍ਹ ਮੈਨੂੰ ਥੋੜ੍ਹਾ ਕੰਮ ਹੈਗਾ ਜੇ ਕੱਲ੍ਹ ਨਾ ਆਇਆ ਗਿਆ ਤਾਂ ਕੱਲ੍ਹ ਸ਼ਾਮ ਨੂੰ ਦੇਖਾਂਗਾ ਜੀ ਫਿਰ ਕਿਉਂਕਿ ਕਾਫੀ ਦਿਨਾਂ ਤੋਂ ਦਰਦ ਬਹੁਤ ਜ਼ਿਆਦਾ ਹੋ ਰਿਹਾ ਸਰ ਅੱਛਾ ਠੰਡੀ ਵੀ ਨਹੀਂ ਖਾਣੀ ਅਤੇ ਸਰ ਜ਼ਿਆਦਾ ਗਰਮ ਵੀ ਨਹੀਂ ਖਾਣੀ ਅਤੇ ਰੋਟੀ ਵਗੈਰਾ ਖਾ ਸਕਦੇ ਆ ਸਰ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਬਹੁਤ ਬਹੁਤ ਧੰਨੇਵਾਦ ਸਰ ਓਕੇ ਜੀ ਸਰ ਥੈਂਕ ਯੂ